ਐਂਬੂਲੈਂਸ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਹਰ ਮੁਹੱਲੇ ਵਿੱਚ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੇੈ ਕਿਉਂਕਿ ਐਂਬੂਲੈਂਸ ਦੀ ਕਮੀ ਕਾਰਨ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਕੋਈ ਗਰਭ ਅਵਸ ਅਵਸਥਾ ਵਿੱਚ ਔਰਤ ਨੂੰ ਹਸਪਤਾਲ ਜਾਣ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਉਹਨਾਂ ਦੇ ਘਰ ਵਿੱਚ ਜਾਣ ਲਈ ਕੋਈ ਸਾਧਨ ਵੀ ਨਹੀਂ ਹੁੰਦਾ ਹੈ ਲੋਕਾਂ ਦੀ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਤਾਂ ਵੀ ਉਹਨਾਂ ਨੂੰ ਜਾਣ ਲਈ ਕੋਈ ਸਾਧਨ ਨਹੀਂ ਮਿਲਦਾ ਜੇਕਰ ਐਂਬੂਲੈਂਸ ਦੀ ਸੁਵਿਧਾ ਹੁੰਦੀ ਤਾਂ ਉਹ ਉਸ ਵਿੱਚ ਅਸਾਨੀ ਨਾਲ਼ ਹੋਸਪੀਟਲ ਜਾ ਸਕਦੀ ਸੀ ਅਤੇ ਕਈ ਵਾਰ ਕਿਸੀ ਦੇ ਐਕਸੀਡੈਂਟ ਹੋਣ ਦੀ ਹਾਲਤ ਵਿੱਚ ਜੋ ਉਸ ਨੂੰ ਮੁੱਢਲੀ ਸਹਾਇਤਾ ਮਿਲਣੀ ਚਾਹੀਦੀ ਸੀ ਉਹ ਉਸ ਤੋਂ ਵੀ ਵਾਂਝਾ ਰਹਿ ਜਾਂਦੇ ਹਨ ਕਿਉਂਕਿ ਐਂਬੂਲੈਂਸ ਵਿੱਚ ਹਰ ਪ੍ਰਕਾਰ ਦੀ ਸੁਵਿਧਾ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ ਜਿਸ ਨਾਲ਼ ਪੀੜਤ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕਦੀ ਹੈ ਐਂਬੂਲੈਂਸ ਬਹੁਤ ਹੀ ਜ਼ ਜ਼ਰੂਰੀ ਸਾਧਨ ਹੈ ਜਿਸ ਨਾਲ਼ ਲੋਕਾਂ ਦੀਆਂ ਰੋਜ਼ਾਨਾ ਜ਼ਿੰਦਗੀ ਵਿੱਚ ਮੁਸ ਮੁਸੀਬਤਾਂ ਦਾ ਸਾਹਮਣਾ ਕਰਨ ਤੋਂ ਬਚ ਸਕਦੇ ਹਨ ਐਂਬੂਲੈਂਸ ਹਰ ਇੱਕ ਪਿੰਡ ਵਿੱਚ ਹੋਣੀ ਜ਼ਰੂਰੀ ਹੈ ਤਾਂ ਜੋ ਮੁਸੀਬਤ ਦੇ ਟਾਈਮ ਵਿੱਚ ਉਸ ਦੀ ਮਦਦ ਦੁਆਰਾ ਕਿਸੇ ਦੀ ਜਾਨ ਬਚਾਈ ਜਾ ਸਕੇ